ਮੇਰਾ ਨਾਮ ਮੋਨੀਕਾ ਹੈ ਮੈਂ ਤੁਹਾਨੂੰ ਅੱਜ ਆਪਣੇ ਸਕੂਲ ਘਰ ਦੇ ਕੋਲ ਬਣਿਆ ਹੋਇਆ ਸਵੀਮਿੰਗ ਪੂਲ ਬਾਰੇ ਦੱਸਣਾ ਚਾਹੁੰਦੀ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਮੈਨੂੰ ਤੈਰਨਾ ਨਹੀਂ ਆਉਂਦਾ ਸੀ ਮੇਰੇ ਪਾਪਾ ਜੀ ਹਰ ਰੋਜ਼ ਤੈਰਨ ਜਾਂਦੇ ਹੁੰਦੇ ਸੀ ਅਤੇ ਮੈਂ ਉਹਨਾਂ ਨੂੰ ਇੱਕ ਦਿਨ ਕਿਹਾ ਮੈਂ ਵੀ ਤੈਰਨਾ ਸਿੱਖਣਾ ਹੈ ਮੈਨੂੰ ਆਪਣੇ ਨਾਲ ਹਰ ਰੋਜ਼ ਮੇਰੇ ਪਾਪਾ ਜੀ ਤੈਰਨ ਲਈ ਲੈ ਕੇ ਜਾਂਦੇ ਸਨ ਅਤੇ ਮੈਨੂੰ ਤੈਰਨਾ ਸਿਖਾਉਂਦੇ ਸੀ ਮੈਂ ਕਈ ਵਾਰ ਤਾਂ ਤੈਰਦੀ ਤੈਰਦੀ ਇੱਕ ਵਾ ਦਿਨ ਡੁੱਬਣ ਤੋਂ ਬਚੀ ਮੇਰੇ ਪਾਪਾ ਜੀ ਕੋਲ ਸੀ ਉਹਨਾਂ ਨੇ ਮੈਨੂੰ ਬਚਾ ਲਿਆ ਜਦੋਂ ਮੈਨੂੰ ਚੰਗੀ ਤਰ੍ਹਾਂ ਤੈਰਨਾ ਆ ਗਿਆ ਤਾਂ ਮੈਂ ਆਪਣੀ ਸਾਰੇ ਸਕੂਲ ਦੀਆਂ ਸਹੇਲੀਆਂ ਨੂੰ ਕਿਹਾ ਕਿ ਮੈਨੂੰ ਨਾ ਤੈਰਨਾ ਆ ਗਿਆ ਹੈ ਜੇ ਤੁਸੀਂ ਸਾਰਿਆਂ ਨੇ ਵੀ ਸਿੱਖਣਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਤੈਰਨਾ ਸਿਖਾਊਂਗੀ ਉਹ ਸਾਰੇ ਜਣੇ ਬੋਲੇ ਹਾਂ ਹਾਂ ਅਸੀਂ ਵੀ ਸਿੱਖਣਾ ਹੈ ਮੈਂ ਉਹਨਾਂ ਨੂੰ ਕਿਹਾ ਤੁਸੀਂ ਕੱਲ੍ਹ ਨੂੰ ਸਵੇਰ ਨੂੰ ਆ ਜਿਓ ਮੈਂ ਤੁਹਾਨੂੰ ਸਾਰਿਆਂ ਨੂੰ ਤੈਰਨਾ ਸਿਖਾਉਂਗੀ ਜਦੋਂ ਉਹ ਮੇਰੇ ਘਰ ਦੇ ਕੋਲ ਆ ਗਈਆਂ ਮੈਂ ਉਹਨਾਂ ਨੂੰ ਤੈਰਨਾ ਸਿਖਾਇਆ ਅਤੇ ਉਹ ਵੀ ਬਹੁਤ ਖੁਸ਼ ਹੋ ਗਏ ਕਿਉਂਕਿ ਅਤੇ ਮੈਂ ਸਾਰੇ ਸਕੂਲ ਵਿੱਚ ਤੈ ਸਾਡੇ ਨਾ ਇੱਕ ਵ ਸਕੂ ਇੱਕ ਦਿਨ ਸਾਡੇ ਸਕੂਲ ਵਿੱਚ ਤੈਰਨ ਦਾ ਪ੍ਰੋਗਰਾਮ ਹੋਇਆ ਉਸ ਵਿੱਚ ਮੈਂ ਫਸਟ ਆਈ ਅਤੇ ਸਾਰਿਆਂ ਨੇ ਮੇਰੇ ਲੀਏ ਬਹੁਤ ਜ਼ਿਆਦਾ ਤਾੜੀਆਂ ਵੀ ਵਜਾਈਆਂ ਅਤੇ ਉਸ ਵਿੱਚ ਮੈਨੂੰ ਪਹਿਲੇ ਨੰਬਰ 'ਤੇ ਪ੍ਰਾਈਜ ਮਿਲਿਆ ਮੈਡਲ ਮਿਲਿਆ ਅਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ